ਮੇਰਾ ਇੱਕ ਰਿਸ਼ਤੇਦਾਰ ਦਿਲ ਦੀ ਬਿਮਾਰੀ ਤੋਂ ਬਹੁਤ ਸਮੇਂ ਤੋਂ ਜੂਝ ਰਿਹਾ ਹੈ ਉਹ ਆਪ ਵੀ ਪਰੇਸ਼ਾਨ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਤਾਂ ਪਰੇਸ਼ਾਨ ਹੋਣਾ ਹੀ ਹੈ ਮੈਨੂੰ ਵੀ ਉਸ ਦੇ ਬਾਰੇ ਜਦੋਂ ਪਤਾ ਲੱਗਿਆ ਤਾਂ ਮੇਰੇ ਦਿਮਾਗ ਦੇ ਵਿੱਚ ਕੁਝ ਗੱਲਾਂ ਆਈਆਂ ਕਿਉਂ ਨਾ ਵੀ ਮੈਂ ਇਸ ਨੂੰ ਅਜਿਹੀ ਸਲਾਹ ਦੇਵਾਂ ਵੀ ਜਿਹਦੇ ਨਾਲ ਜਿਹੜਾ ਕਿ ਚਿੰਤਾ ਮੁਕਤ ਹੋ ਜਾਵੇ ਇਹ ਕਿਉਂਕਿ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦਾ ਸੀ ਤਾਂ ਮੈਂ ਉਸ ਨੂੰ ਬਹੁਤ ਸਾਰੇ ਸੁਝਾਅ ਦਿੱਤੇ ਜਿਵੇਂ ਕਿ ਰੋਜ਼ਾਨਾ ਕਸਰਤ ਕਰੇ ਲਾਈਟ ਕਸਰਤ ਕਰਨੀ ਹੈ ਹਾਰਡ ਕਸਰਤ ਨਹੀਂ ਕਰਨੀ ਆਪਾਂ ਯੋਗਾ ਡੇਲੀ ਕਰੇ ਅਤੇ ਵਾਕਿੰਗ ਵੀ ਉਹਨੂੰ ਸਵੇਰੇ ਸ਼ਾਮ ਦਸ ਮਿੰਟ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਖਾਣੇ ਦੇ ਲਈ ਵੀ ਮੈਂ ਉਹਨੂੰ ਕਿਹਾ ਵੀ ਤੁਸੀਂ ਲਾਈਟ ਖਾਣਾ ਲੈਣਾ ਹੈਗਾ ਹਾਰਡ ਖਾਣਾ ਨਹੀਂ ਖਾਣਾ ਪੀਜ਼ਾ ਬਰਗਰ ਸਮੋਸਾ ਇੱਦਾਂ ਦੀਆਂ ਚੀਜ਼ਾਂ ਤੋਂ ਬਿਲਕੁਲ ਪਰਹੇਜ਼ ਕਰਨਾ ਹੈਗਾ ਅਦਰਵਾਈਜ਼ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਨਹੀਂ ਕਰਦੇ ਤਾਂ ਜਿਹੜੀ ਆਪਣੀ ਪ੍ਰੋਬਲਮ ਹੈਗੀ ਉਹ ਵੱਧਦੀ ਹੀ ਜਾਵੇਗੀ ਇਸ ਖਾਣ ਪੀਣ ਦੇ ਪਰਹੇਜ਼ ਦੇ ਨਾਲੋਂ ਸਭ ਤੋਂ ਵੱਧ ਜ਼ਰੂਰੀ ਹੈ ਤਣਾਅ ਮੁਕਤ ਰਹਿਣਾ ਤਣਾਅ ਮੁਕਤ ਵੀ ਬਿਲਕੁਲ ਵੀ ਹੋਣੇ ਜਿਹੜੇ ਕੀ ਆ ਟੈਂਸ਼ਨ ਨਹੀਂ ਲੈਣੀ ਕਿਸੇ ਪ੍ਰਕਾਰ ਦੀ ਆਪਣੇ ਆਪ ਨੂੰ ਜਿਹੜਾ ਖੁਸ਼ ਰੱਖਣਾ ਕੋਈ ਇਹ ਲਾਈਟ ਸੰਗੀਤ ਸੁਣ ਕੇ ਜਾਂ ਕੋਈ ਆਪਦੀ ਆਪਣਾ ਕੋਈ ਸ਼ੌਕ ਪੈਦਾ ਕਰਕੇ ਕੋਈ ਹੋਬੀ ਦੇ ਨਾਲ ਕੋਈ ਪੇਂਟਿੰਗ ਦੇ ਨਾਲ ਠੀਕ ਹੈ ਅਤੇ ਅਦਰਵਾਈਜ਼ ਉਹਦੀ ਜਿਹੜੀ ਐਕਸਰਸਾਈਜ਼ ਹੈ ਉਹ ਤੁਹਾਨੂੰ ਕਰਨੀ ਹੀ ਚਾਹੀਦੀ ਹੈ ਸਵੇਰੇ ਸ਼ਾਮ ਨੋ ਡਾਊਟ ਕਸਰਤ ਦੇ ਨਾਲ ਜਿਹੜਾ ਸਰੀਰ ਹੈ ਤੰਦਰੁਸਤ ਰਹਿੰਦਾ ਹੈਗਾ ਆਪਣਾ ਅਤੇ ਉਹ ਜਿਹੜੀਆਂ ਆਪਣੀਆਂ ਸਰਕੂਲਰ ਹੈਗਾ ਬਲੱਡ ਦਾ ਉਹ ਚੱਲਦਾ ਰਹੇਗਾ ਤਾਂ ਇਸ ਨੂੰ ਸੁਬਹ ਸ਼ਾਮ ਆ ਜਿਹੜੀ ਆਪਣੀ ਕਸਰਤ ਜ਼ਰੂਰ ਕਰੇ ਖਾਣ ਪੀਣ ਦਾ ਪਰਹੇਜ਼ ਰੱਖੇ ਅਤੇ ਤਣਾਅ ਮੁਕਤ ਜ਼ਿੰਦਗੀ ਹੈ ਉਹਨੂੰ ਬਤੀਤ ਕਰਨੀ ਚਾਹੀਦੀ ਹੈ ਅਤੇ ਰੈਗੂਲਰ ਡਾਕਟਰ ਤੋਂ ਜਿਹੜਾ ਚੈੱਕ ਅਪ ਆ ਉਹਦਾ ਡੇਲੀ ਹੋਣਾ ਚਾਹੀਦਾ